ਮ ਮੈਂ ਅਮਨ ਰੰਧਾਵਾ ਬੋਲ ਰਿਹਾ ਸੀ ਤ ਤੁਸੀਂ ਸਾਡੇ ਘਰ ਕੁੱਕ ਦਾ ਕੰਮ ਕਰਦੇ ਹੋ ਅਤੇ ਪਹਿਲੀ ਗੱਲ ਤਾਂ ਤੁਸੀਂ ਅੱਜ ਆਏ ਨਹੀਂ ਅਤੇ ਦੱਸਣਾ ਤਾਂ ਸੀ ਨਾ ਤੁਸੀਂ ਆ ਅੱਛਾ ਅਤੇ ਬਾਕੀ ਤੁਸੀਂ ਨਾ ਖਾਣਾ ਕੱਲ੍ਹ ਨੂੰ ਖ਼ਰਾਬ ਬਣਾਇਆ ਸੀ ਪਰਸੋਂ ਵੀ ਕੱਲ੍ਹ ਵਾਲਾ ਖਾਣੇ 'ਚ ਨਾ ਥੋੜ੍ਹਾ ਨਮਕ ਜ਼ਿਆਦਾ ਸੀ ਅਤੇ ਤੁਹਾਨੂੰ ਪਤਾ ਨਾ ਮੇਰੇ ਮਦਰ ਬੀ ਪੀ ਦੇ ਪੇਸ਼ੰਟ ਨੇ ਅਤੇ ਉਹਨਾਂ ਨੂੰ ਤਕਲੀਫ ਹੁੰਦੀ ਹੈ ਥੋੜ੍ਹੀ ਦੇਖੋ ਰੋਜ਼ ਰੋਜ਼ ਹੀ ਸਾਡਾ ਇਹ ਹੈਗਾ ਤੁਸੀਂ ਰੋਜ਼ ਹੀ ਕੋਈ ਨਾ ਕੋਈ ਗੜਬੜ ਕਰ ਦਿੰਦੇ ਹੋ ਕਦੇ ਮਸਾਲਾ ਤੇਜ਼ ਹੋ ਜਾਂਦਾ ਕਦੇ ਸਬਜ਼ੀ ਕੱਚੀ ਹੁੰਦੀ ਹੈ ਕਦੀ ਕਿਵੇਂ ਅਤੇ ਫਿਰ ਸਾਡੇ ਘਰ ਦਾ ਖਾਣਾ ਕੌਣ ਬਣਾਇਆ ਕਰੇਗਾ ਅਤੇ ਫਿਰ ਹੁਣ ਅਸੀਂ ਕੀ ਅਰੇਂਜਮੈਂਟ ਕਰੀਏ ਨਾ ਹੁਣ ਦੋ ਦਿਨਾਂ 'ਚ ਸਾ ਦੋ ਦਿਨਾਂ ਵਾਸਤੇ ਤਾਂ ਕੋਈ ਕੁੱਕ ਆ ਹੀ ਨਹੀਂ ਸਕਦਾ ਸਾਡੇ ਕੋਲ ਅਤੇ ਫਿਰ ਹੁਣ ਤੁਸੀਂ ਆਪਣੇ ਬਦਲੇ ਕਿਸੇ ਨੂੰ ਭੇਜੋ ਜਾਂ ਕੁਝ ਵੀ ਤਾਂ ਕਰੋ ਹੁਣ ਸਾਡੀ ਵੀ ਤਾਂ ਪ੍ਰੋਬਲਮ ਹੈ ਨਾ ਫਿਰ ਹੁਣ ਅਤੇ ਅੱਜ ਦਾ ਅਤੇ ਅੱਜ ਦਾ ਖਾਣਾ ਫਿਰ ਕਿਵੇਂ ਅਤੇ ਸਵੇਰ ਦਾ ਤਾਂ ਹੁਣ ਕਿਸੇ ਨੇ ਕੁਛ ਨਹੀਂ ਖਾਧਾ ਅਤੇ ਫਿਰ ਉਹ ਆਪਣੇ ਬਦਲੇ ਕਿਸ ਨੂੰ ਭੇਜੋ ਨਾ ਹੁਣ ਨਹੀਂ ਤਾਂ ਫਿਰ ਮੈਂ ਤੁਹਾਡੀ ਸੈਲਰੀ ਕੱਟਾਂ ਨਹੀਂ ਹੁਣ ਤੁਸੀਂ ਅਚਾਨਕ ਹੀ ਗਏ ਚਲੇ ਤੁਸੀਂ ਮੈਨੂੰ ਪਹਿਲਾਂ ਬਤਾ ਦੱਸ ਕੇ ਜਾਂਦੇ ਫਿਰ ਤਾਂ ਮੈਂ ਤੁਹਾਡੇ ਸੈਲਰੀ ਨਹੀਂ ਕੱਟਣੀ ਸੀ ਤੁਸੀਂ ਬਿਨਾਂ ਬਿਤਾਏ ਚਲੇ ਗਏ ਅਤੇ ਮੈਂ ਤਾਂ ਹੁਣ ਕੱਟਣੀ ਹੈ ਦੋ ਦਿਨ ਸੈਲਰੀ ਹਾਂ ਉਹ ਮੈਂ ਤੁਹਾਡੀ ਗੱਲ ਸਮਝਦੀ ਹਾਂ ਪ੍ਰੋਬਲਮ ਹੈ ਅਤੇ ਫਿਰ ਵੀ ਨਹੀਂ ਫਿਰ ਉਹ ਤੁਹਾਨੂੰ ਹਾਫ ਹੀ ਮਿਲੇਗੀ ਸੈਲਰੀ ਜੇ ਤੁਸੀਂ ਕਿਸੇ ਹੋਰ ਨੂੰ ਵੀ ਭੇਜੋ ਫਿਰ ਉਹ ਖਾਣਾ ਵੀ ਸਹੀ ਉਹ ਸਾਨੂੰ ਕਿਵੇਂ ਦੇਊਗਾ ਇਹ ਤਾਂ ਪਤਾ ਕੋਈ ਤੁਹਾਨੂੰ ਉਹਦਾ ਕਿਵੇਂ ਬਣਾਵੇਗਾ ਕਿਵੇਂ ਨਹੀਂ ਠੀਕ ਹੈ ਫਿਰ ਅੱਜ ਕੱਲ੍ਹ ਭੇਜੋਗੇ ਕਿ ਅੱਜ ਠੀਕ ਹੈ ਓਕੇ